ਜਲੰਧਰ ਦਾ ਨਾਮ ਜਲੰਧਰ ਦੇ ਨਾਮ 'ਤੇ ਰੱਖਿਆ ਗਿਆ ਹੈ ਇੱਕ ਸ਼ੈਤਾਨ ਰਾਜੇ ਜੋ ਆ ਪਾਣੀ ਵਿੱਚ ਰਹਿੰਦਾ ਸੀ ਜਿਵੇਂ ਕਿ ਉਸ ਦੇ ਨਾਮ ਜਲ ਅਤੇ ਆਧਾਰ ਦਾ ਸੁਝਾਵ ਦਿੰਦਾ ਹੈ ਇਹ ਉੱਨੀ ਸੌ ਤਰਵੰਜਾ ਤੱਕ ਪੰਜਾਬ ਦੀ ਰਾਜਧਾਨੀ ਸੀ ਜਦੋਂ ਇਸ ਥਾਂ ਇਸ ਦੀ ਥਾਂ ਚੰਡੀਗੜ੍ਹ ਨੇ ਲੈ ਲਈ ਦੂਸਰੇ ਕਹਿੰਦੇ ਹਨ ਕਿ ਜਲੰਧਰ ਇਸ ਤੱਥ ਤੋਂ ਲਿਆ ਗਿਆ ਹੈ ਕਿ ਇਹ ਦੋ ਨਦੀਆਂ ਜਲ ਆ ਆ ਆਦਰ ਦੇ ਵਿਚਕਾਰ ਸਥਿਤ ਹੈ ਸਿੱਖ ਸਮਰਾਜ ਅਤੇ ਬ੍ਰਿਟਿਸ਼ ਰਾਜ ਦੇ ਦੌਰਾਨ ਇੱਕ ਮੁੱਖ ਕੇਂਦਰ ਬਣਨ ਤੋਂ ਪਹਿਲਾਂ ਸੱਤਵੀਂ ਸਦੀ ਵਿੱਚ ਇੱਕ ਰਾਜਪੂਤ ਰਾਜ ਦੀ ਰਾਜਧਾਨੀ ਹੋਣਾ ਗਜਨਵੀਂ ਸਾਮਰਾਜ ਦਾ ਹਿੱਸਾ ਅਤੇ ਬਾਅਦ ਵਿੱਚ ਦਿੱਲੀ ਸੁਲਤਾਨ ਅਤੇ ਮੁਗਲ ਸਮਰਾਜ ਸ਼ਾਮਿਲ ਹੈ ਸਿੱਖ ਸਮਰਾਜ ਅਤੇ ਬ੍ਰਿਸ਼ਟ ਰਾਜ ਦੇ ਦੌਰਾਨ ਇੱਕ ਮੁੱਖ ਕੇਂਦਰ ਬਣਨ ਤੋਂ ਪਹਿਲਾਂ ਸੱਤਵੀਂ ਸਦੀ ਵਿੱਚ ਇੱਕ ਰਾਜਪੂਤ ਰਾਜ ਦੀ ਰਾਜਧਾਨੀ ਹੋਣਾ ਗਜ਼ਨਵੀਂ ਸਮਰਾਜ ਦਾ ਹਿੱਸਾ ਹੈ